ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਆਪਣੇ ਇਲਾਕੇ ਦੇ ਕਿਸਾਨਾਂ ਲਈ ਬਹੁਤ ਹੀ ਸੁਵਿਧਾ ਉਪਲਧ ਕਰਵਾ ਦੇਵਾਂ ਅਤੇ ਮਜ਼ਦੂਰਾਂ ਦੀ ਮਦਦ ਲਈ ਉਹਨਾਂ ਦੀ ਰੋਜ਼ ਦੀ ਦਿਹਾੜੀ ਨੂੰ ਇੱਕ ਫਿਕਸ ਕੀਤਾ ਜਾਵੇ ਤਾਂ ਜੋ ਉਹਨਾਂ ਨਾਲ ਕੋਈ ਆਧਾਰ ਮੁੱਲ ਨਾ ਕੀਤਾ ਜਾਵੇ ਹਰ ਮਜ਼ਦੂਰ ਨੂੰ ਸਵੇਰ ਤੋਂ ਸ਼ਾਮ ਦੀ ਦਿਹਾੜੀ ਹੈ ਜਿਹੜੀ ਉਹ ਟਾਈਮ 'ਤੇ ਮਿਲ ਸਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਬਾਰੇ ਮੈਂ ਜਾਣਕਾਰੀ ਦੇਵਾਂ ਅਤੇ ਅ ਕਿਸਾਨਾਂ ਨੂੰ ਪਾਣੀ ਕਿਵੇਂ ਬਚਾਇਆ ਜਾ ਸਕਦਾ ਉਸ ਬਾਰੇ ਦੀ ਜਾਗਰੂਕ ਕਰਾਂ ਕਿਸਾਨਾਂ ਨੂੰ ਨਵੇਂ ਨ ਫਸਲਾਂ ਦੇ ਬੀਜ ਉਪਲਬਧ ਕਰਵਾਈਏ ਤਾਂ ਕਿ ਕਿਸਾਨ ਹੈ ਜਿਹੜੀ ਉਹ ਕਿਸਾਨ ਆਪਣੀ ਫਸਲ ਨੂੰ ਚੰਗੀ ਤਰ੍ਹਾਂ ਉਪਜਾਊ ਕਰ ਸਕੇ ਅਤੇ ਉਹਦੀ ਪੈਦਾਵਾਰ ਹੈ ਜਿਹੜੀ ਉਹ ਵੀ ਵੱਧ ਸਕੇ ਕਿਸਾਨ ਦੀ ਪੈਦਾਵਾਰ ਦੇ ਨਾਲ ਮਜ਼ਦੂਰਾਂ ਦਾ ਵੀ ਹੱਥ ਹੈ ਜਿਹੜਾ ਉਹ ਬਹੁਤ ਵੱਡੇ ਪੱਧਰ 'ਤੇ ਹੁੰਦਾ ਹੈ ਇੱਕ ਇਕੱਲਾ ਕਿਸਾਨ ਹੈ ਜਿਹੜਾ ਉਹ ਆਪਣੇ ਖੇਤ ਦੇ ਵਿੱਚ ਖੇਤੀ ਨਹੀਂ ਕਰ ਸਕਦਾ ਕਿਸਾਨ ਨੂੰ ਮਜ਼ਦੂਰ ਦੀ ਮਦਦ ਲੈਣੀ ਹੀ ਪੈਂਦੀ ਹੈ ਇਸ ਲਈ ਕਿਸਾਨ ਅਤੇ ਮਜ਼ਦੂਰ ਹੈ ਬਰਾਬਰ ਦਾ ਹੀ ਹੱਥ ਹੁੰਦਾ ਹੈ ਮਜ਼ਦੂਰ ਨੂੰ ਮੈਂ ਇੱਕ ਚੰਗਾ ਮੌਕਾ ਦੇਵਾਂ ਕਿ ਉਹ ਹਰ ਕਿਸਾਨ ਦੇ ਨਾਲ ਜੁੜ ਕੇ ਉਹਨਾਂ ਦਾ ਸਾਥ ਦੇਵੇ ਅਤੇ ਆਪਣਾ ਜਿਹੜਾ ਕਮਾਈ ਦਾ ਸਾਧਨ ਹੈ ਉਹ ਵੀ ਬਣੇ ਅਤੇ ਉਹਨਾਂ ਨੂੰ ਮੈਂ ਹੋਰ ਵੀ ਚੰਗੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਕੁਛ ਇੱਦਾਂ ਫੈਸਲਿਟੀਜ਼ ਪ੍ਰੋਵਾਈਡ ਕਰਾਵਾਂ ਤਾਂ ਕਿ ਮਜ਼ਦੂਰ ਅਤੇ ਕਿਸਾਨ ਦੋਨੋਂ ਆਪਸ 'ਚ ਖੁਸ਼ ਰਹਿਣ ਧੰਨਵਾਦ